ਹੈਲੋ ਵੀਰੇ ਹੈਲੋ ਵੀਰੇ ਮੈਂ ਸਵੀਗੀ ਤੋਂ ਗੱਲ ਸਵੀਗੀ ਤੋਂ ਬੋਲ ਰਹੇ ਹੋ ਯੈਸ ਵੀਰੇ ਮੇਰਾ ਨਾਮ ਵੀਰਪਾਲ ਆ ਮੈਂ ਬਠਿੰਡੇ ਦੇ ਰਹਿਣ ਵਾਲੀ ਹਾਂ ਮੈਂ ਆਪਣਾ ਔਡਰ ਪਲੇਸ ਕਰਨਾ ਸੀ ਹਾਂਜੀ ਪੀਜ਼ਾ ਟੂ ਲਾਰਜ ਐਂਡ ਪਾਸਤਾ ਟੂ ਪਲੇਟਸ ਓਕੇ ਪਲੀਜ਼ ਡਿਲੀਵਰੀ ਅਡਰੈਸ ਹੈ ਜਿਹੜਾ ਵੀ ਮੇਰਾ ਨੋਟ ਕਰ ਲਓ ਠੀਕ ਹੈ ਸ਼ਾਹ ਨਮਕੀਨ ਚੰਦਨ ਨਗਰ ਬਠਿੰਡਾ ਜੂਸ ਵਾਲੀ ਗਲੀ ਵੀਰੇ ਧਿਆਨ ਨਾਲ ਨੋਟ ਕਰ ਲਓ ਚੰਦਨ ਨਗਰ ਜਿਹੜਾ ਹੈਗਾ ਬਠਿੰਡੇ ਦੇ ਵਿੱਚ ਦੋ ਆ ਸ਼ਾਹ ਨਮਕੀਨ ਦੇ ਕੋਲ ਜਿਹੜਾ ਚੰਦਨ ਨਗਰ ਆ ਤੁਸੀਂ ਉਸ ਕੋਲ ਆਉਣਾ ਠੀਕ ਆ ਪਿਛਲੀ ਵਾਰ ਮੇਰਾ ਜਿਹੜਾ ਔਡਰ ਆ ਵੀਰੇ ਉਹ ਗਲਤ ਅਡਰੈਸ 'ਤੇ ਜਾ ਵੜਿਆ ਸੀ ਸੋ ਮੈਨੂੰ ਔਡਰ ਲੈਣ ਦੇ ਵਿੱਚ ਬਹੁਤ ਪ੍ਰੋਬਲਮ ਹੋਈ ਉਹਨਾਂ ਨੇ ਮੇਰੇ ਨਾਲ ਡਰੀ ਡਿਲੀਵਰੀ ਬੋਏ ਦਾ ਵੀ ਜਿਹੜਾ ਅਡਰੈਸ ਆ ਉਹ ਸ਼ੇਅਰ ਨਹੀਂ ਕੀਤਾ ਸੀ ਪਲੀਜ਼ ਤੁਸੀਂ ਜਿਹੜਾ ਹੈਗਾ ਡਿਲੀਵਰੀ ਬੋਏ ਦਾ ਜਿਹੜਾ ਨੰਬਰ ਹੈਗਾ ਉਹ ਵੀ ਮੇਰੇ ਨਾਲ ਸ਼ੇਅਰ ਕਰ ਦਿਓ ਅਤੇ ਮੈਂ ਪੇਮੈਂਟ ਵੀ ਜਿਹੜੀ ਹੈਗੀ ਆ ਉਹਨਾਂ ਨੂੰ ਕਰ ਦੂੰਗੀ ਪਲੀਜ਼ ਮੈਂ ਵਾਰ ਵਾਰ ਕਹਿ ਰਹੀ ਹਾਂ ਵੀ ਜਿਹੜਾ ਮੇਰਾ ਅਡਰੈਸ ਹੈਗਾ ਉਹ ਹੈਗਾ ਸ਼ਾਹ ਨਮਕੀਨ ਚੰਦਨ ਨਗਰ ਬਠਿੰਡਾ ਜੂਸ ਵਾਲੀ ਗਲੀ ਦੇ ਵਿੱਚ ਫਲੋਰ ਨੰਬਰ ਟਵੈਲਵ ਐਂਡ ਰੂਮ ਨੰਬਰ ਵਨ ਟੂ ਫੋਰ ਜ਼ੀਰੋ